ਅਸੀਂ ਪਿੰਡ ਵਿੱਚ ਰਹਿੰਦੇ ਹਾਂ ਅਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਪਿੰਡਾਂ ਵਾਲੇ ਲੋਕਾਂ ਦੀ ਜਗ੍ਹਾ ਬਹੁਤ ਹੀ ਹੁੰਦੀ ਹੈ ਇਸ ਤਰ੍ਹਾਂ ਹੀ ਸਾਡੇ ਘਰ ਇੱਕ ਖੁੱਲ੍ਹਾ ਵਿਹੜਾ ਹੈ ਜਿਸ ਵਿੱਚ ਅਸੀਂ ਕਈ ਸਾਰੇ ਪੇੜ ਪੌਦੇ ਉਗਾਏ ਹਨ ਅਤੇ ਵੱਡੇ ਦਰਖਤ ਵੀ ਉਗਾਏ ਹਨ ਇਹਨਾਂ ਵੱਲ ਦੇਖ ਕੇ ਚਿੜੀਆਂ ਬਹੁਤ ਹੀ ਆਕਰਸ਼ਿਤ ਹੁੰਦੀਆਂ ਹਨ ਅਸੀਂ ਹੋਰ ਚਿੜੀਆਂ ਅਤੇ ਹੋਰ ਪੰਛੀਆਂ ਨੂੰ ਆਕਰਸ਼ਿਤ ਕਰਨ ਲਈ ਕਈ ਸਾਰੀਆਂ ਵੇਲਾਂ ਵੀ ਉਗਾਈਆਂ ਹਨ ਅਤੇ ਜਗ੍ਹਾ ਜਗ੍ਹਾ 'ਤੇ ਪਾਣੀ ਦੇ ਕਟੋਰੀਆਂ ਰੱਖੀਆਂ ਹੋਈਆਂ ਹਨ ਤਾਂ ਕਿ ਉਹਨਾਂ ਨੂੰ ਤਰੇਹ ਲੱਗੇ ਤਾਂ ਉਹ ਪਾਣੀ ਪੀ ਸਕਣ ਅਤੇ ਉਹਨਾਂ ਦੇ ਖਾਣ ਵਾਸਤੇ ਵੀ ਇੰਤਜ਼ਾਮ ਕੀਤਾ ਹੋਇਆ ਹੈ ਆਲ੍ਹਣੇ ਵੀ ਬਣਾਏ ਹੋਏ ਹਨ ਪੰਛੀਆਂ ਦੇ ਰਹਿਣ ਵਾਸਤੇ ਅਸੀਂ ਪੇੜਾਂ ਉੱਤੇ ਨਕਲੀ ਆਲ੍ਹਣੇ ਲਗਾਏ ਹੋਏ ਹਨ ਤਾਂ ਕਿ ਉਹ ਉੱਥੇ ਆਰਾਮ ਕਰ ਸਕਣ ਰਹਿ ਸਕਣ ਅਤੇ ਸਕੂਨ ਪਾ ਸਕਣ ਅਤੇ ਠੰਡੀ ਹਵਾ ਲੈ ਸਕਣ ਇਸ ਨਾਲ ਉਹਨਾਂ ਦਾ ਉਹਨਾਂ ਨੂੰ ਵਾਤਾਵਰਨ ਇਸ ਇਹ ਵਾਤਾਵਰਨ ਉਹਨਾਂ ਨੂੰ ਬਹੁਤ ਅ ਚੰਗਾ ਲੱਗਦਾ ਹੈ ਅਤੇ ਉਹ ਹੁਣ ਹਾਡੇ ਸਾਡੇ ਨਾਲ ਰਲ ਮਿਲ ਗਈਆਂ ਹਨ ਮੈਂ ਪੰਛੀਆਂ ਲਈ ਅਨਾਜ ਅਤੇ ਪਾਣੀ ਵੀ ਰੱਖਦੀ ਹਾਂ ਪੰਛੀਆਂ ਦੇ ਅਨਾਜ ਰੱਖਣ ਵਾਸਤੇ ਮੈਂ ਇੱਕ ਅਲੱਗ ਹੀ ਕੌਲੀ ਲਗਾਈ ਹੋਈ ਹੈ ਅਤੇ ਉਹਨਾਂ ਨੂੰ ਪਾਣੀ ਦੇਣ ਲਈ ਵੀ ਇੱਕ ਕਟੋਰੀ ਲਗਾਈ ਹੋਈ ਹੈ ਹੁਣ ਜਿੱਦਾਂ ਸਰ ਗਰਮੀਆਂ ਆ ਰਹੀਆਂ ਹਨ ਹੁਣ ਗਰਮੀਆਂ ਦੇ ਮੌਸਮ ਵਿੱਚ ਪਾਣੀ ਜ਼ਰੂਰੀ ਜਿੱਦਾਂ ਸਾਡੇ ਲਈ ਪਾਣੀ ਜ਼ਰੂਰੀ ਹੈ ਉਸੇ ਤਰ੍ਹਾਂ ਉਹਨਾਂ ਲਈ ਵੀ ਪਾਣੀ ਬਹੁਤ ਜ਼ਰੂਰੀ ਹੈ ਇਸ ਕਰਕੇ ਮੈਂ ਜਗ੍ਹਾ ਜਗ੍ਹਾ 'ਤੇ ਪੰਛੀਆਂ ਲਈ ਆਪਣੇ ਛੱਤ ਅਤੇ ਬਾਗ ਵਿੱਚ ਜਗ੍ਹਾ ਜਗ੍ਹਾ 'ਤੇ ਪਾਣੀ ਦੀ ਕਟੋਰੀਆਂ ਰੱਖੀਆਂ ਹੋਈਆਂ ਹਨ ਤਾਂ ਕਿ ਉਹ ਪਾਣੀ ਪੀ ਸਕਣ ਅਤੇ ਖੁਸ਼ ਰਹਿਣ ਧੰਨਵਾਦ